ਆਨਲਾਈਨ ਜੈਕਟ ਮੈਂ ਖਰੀਦਣੀ ਸੀ ਅਤੇ ਜਿਹੜਾ ਮੇਰਾ ਸਾਈਜ਼ ਹੈ ਉਹ ਥਟੀ ਸਿਕਸ ਆ ਐਤੇ ਮੈਨੂੰ ਨੀਲਾ ਰੰਗ ਬੜਾ ਪਸੰਦ ਆ ਉਸ ਲਈ ਪਹਿਲਾਂ ਮੈਂ ਐਮਾਜੋਨ ਦੀ ਸਾਈਟ 'ਤੇ ਜਾ ਕੇ ਆਨਲਾਈਨ ਉਹਨਾਂ ਦੇ ਜੋ ਬ੍ਰਾਂਡ ਸੀ ਕਿਹੜੇ ਕਿਹੜੇ ਬ੍ਰਾਂਡ ਉਹਨਾਂ ਕੋਲ ਉਪਲੱਬਧ ਸੀ ਉਹਨਾਂ ਬਾਰੇ ਦੇਖਿਆ ਅਤੇ ਉਹਦੇ ਵਿੱਚੋਂ ਜਿਹੜਾ ਮੇਰਾ ਨੂੰ ਨਾਈਕੀ ਦੀ ਇੱਕ ਜੈਕਟ ਸੀ ਉਹ ਬੜੀ ਪਸੰਦ ਆਈ ਪਰ ਉਸਦਾ ਉਸ ਦੇ ਵਿੱਚ ਨੀਲਾ ਕਲਰ ਮੈਨੂੰ ਨਹੀਂ ਮਿਲਿਆ ਤਾਂ ਫਿਰ ਮੈਨੂੰ ਉਹ ਚੇਂਜ ਕਰਨਾ ਪਿਆ ਤਾਂ ਮੈਂ ਉਸ ਤੋਂ ਬਾਅਦ ਅਕਟੇਵ ਦੀ ਇੱਕ ਜੋ ਜੈਕਟ ਸੀ ਉਹਨੇ ਮੈਨੂੰ ਬੜਾ ਆਪਣੇ ਵੱਲ ਖਿੱਚਿਆ ਮੈਨੂੰ ਬੜਾ ਹੀ ਪਸੰਦ ਆਈ ਉਹ ਅਤੇ ਮੇਰਾ ਪਸਸ ਪਸੰਦੀਦਾ ਰੰਗ ਸੀ ਜਿਹੜਾ ਨੀਲਾ ਉਹ ਵੀ ਮੈਨੂੰ ਉੱਥੇ ਮਿਲ ਗਿਆ ਅਤੇ ਮੈਂ ਉਸ ਟਾਈਮ ਹੀ ਕਿਉਂਕਿ ਮੇਰਾ ਜੋ ਸਾਈਜ਼ ਸੀ ਉਹ ਵੀ ਉੱਥੇ ਮੈਨੂੰ ਮਿਲ ਚੁੱਕਿਆ ਸੀ ਮੈਂ ਆਰਡਰ ਆਪਣਾ ਪਲੇਸ ਕਰ ਦਿੱਤਾ ਅਤੇ ਕੁਛ ਦਿਨਾਂ ਬਾਅਦ ਜਿਹੜਾ ਆਰਡਰ ਸੀ ਮੇਰਾ ਆ ਗਿਆ ਅਤੇ ਕਿਉਂਕਿ ਮੈਂ ਜਿਹੜੀ ਡਿਲੀਵਰੀ ਲਈ ਸੀ ਉਹ ਪੇਮੈਂਟ ਸੀ ਆਨ ਸਪੋਟ ਸੀ ਅਤੇ ਜਦੋਂ ਡਿਲੀਵਰੀ ਬੋਆਏ ਆਇਆ ਤਾਂ ਮੈਂ ਉਸਨੂੰ ਪੇਮੈਂਟ ਕਰ ਦਿੱਤੀ ਅਤੇ ਮੈਂ ਆਪਣੀ ਜਿਹੜੀ ਉਹ ਜੈਕਟ ਸੀ ਉਹ ਲਈ ਅਤੇ ਜੈਕਟ ਬਿਲਕੁਲ ਜਿਸ ਤਰ੍ਹਾਂ ਮੈਂ ਮੰਗਵਾਈ ਸੀ ਉਸ ਤਰ੍ਹਾਂ ਸੀ ਮੇਰਾ ਸਾਈਜ਼ ਬਹੁਤ ਪਰਫੈਕਟ ਸੀ ਫਿਟ ਸੀ ਮੈਨੂੰ ਅਤੇ ਰੰਗ ਬੜਾ ਵਧੀਆ ਸੀ ਤਾਂ ਜਿਹੜਾ ਮੇਰਾ ਖਰੀਦਣ ਦਾ ਇਹ ਐਕਸਪੀਰੀਅਂਸ ਸੀ ਆਨਲਾਈਨ ਉਹ ਬੜਾ ਚੰਗਾ ਰਿਹਾ ਸਾਰਿਆਂ ਨੂੰ ਕੁਛ